ਪੰਜਾਬ ਦਾ ਵਿਕਾਸ ਹੁਣ ਦੇ ਸਮੇਂ 'ਚ ਬਿਲਕੁਲ ਹੀ ਨਹੀਂ ਹੋ ਰਿਹਾ ਕਿਉਂਕਿ ਹੁਣ ਦੇ ਸਮੇਂ ਵਿੱਚ ਜ਼ਿਆਦਾਤਰ ਨਸ਼ਾ ਭ੍ਰਿਸ਼ਟਾਚਾਰ ਬਹੁਤ ਵਧ ਗਿਆ ਹੈ ਜਿਸ ਸਮੇਂ ਬੱਚਿਆਂ ਨੂੰ ਕਮਾਈ ਕਰਨੀ ਚਾਹੀਦੀ ਹੈ ਉਸ ਸਮੇਂ ਉਹ ਨਸ਼ੇ ਵਿੱਚ ਆਪਣਾ ਸਮਾਂ ਬਰਬਾਦ ਕਰੀ ਜਾ ਰਹੇ ਨੇ ਉਹ ਆਪਣੇ ਮਾਪਿਆਂ ਨੂੰ ਤੰਗ ਕਰਦੇ ਨੇ ਨਸ਼ਾ ਨਸ਼ੇ ਲਈ ਉਹ ਕੁਝ ਵੀ ਕਰ ਲੈਂਦੇ ਨੇ ਉਹ ਚੋਰੀ ਠੱਗੀ ਕੁਛ ਵੀ ਕਰ ਸਕਦੇ ਨੇ ਅਤੇ ਭ੍ਰਿਸ਼ਟਾਚਾਰ ਵੀ ਸਾਡੇ ਪੰਜਾਬ ਦੇ ਵਿਕਾਸ ਵਿੱਚ ਅਟਕ ਰਿਹਾ ਹੈ ਕਿਉਂਕਿ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕੋਈ ਵੀ ਕੰਮ ਰਿਸ਼ਵਤ ਲਏ ਬਿਨਾਂ ਨਹੀਂ ਹੁੰਦਾ ਚਾਹੇ ਆਪਦਾ ਘਰ ਦਾ ਕੰਮ ਹੋਵੇ ਜਾਂ ਫਿਰ ਬਾਹਰ ਕੋਈ ਵੀ ਸਰਕਾਰੀ ਕੰਮ ਹੋਵੇ ਤਾਂ ਉਹ ਰਿਸ਼ਵਤ ਤੋਂ ਬਗੈਰ ਪੂਰਾ ਨਹੀਂ ਹੁੰਦਾ ਹੈ ਇਸ ਲਈ ਸਾਡੇ ਪੰਜਾਬ ਦਾ ਵਿਕਾਸ ਬਿਲਕੁਲ ਵੀ ਨਹੀਂ ਹੋ ਪਾ ਰਿਹਾ ਹੈ